ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਲੱਗ ਅਲੱਗ ਨਸਲਾਂ ਦੇ ਲੋਕ ਤਾਂ ਰਹਿੰਦੇ ਹਨ ਜਿਵੇਂ ਹਿੰਦੂ ਸਿੱਖ ਮੁਸਲਿਮ ਇਸਾਈ ਗੁਜਰਾਤੀ ਬਿਹਾਰ ਦੇ ਭਈਏ ਮਲਿਆਲਮ ਤੇਲੰਗੀ ਮਦਰਾਸੀ ਨੇਪਾਲੀ ਪਾਰਸੀ ਪਰ ਉਹਨਾਂ ਦੇ ਵਿੱਚ ਉਹਨਾਂ ਦੀ ਭਾਸ਼ਾ ਇੱਕੋ ਹੀ ਹੈ ਉਹਨਾਂ ਦੀ ਭਾਸ਼ਾ ਸਿਰਫ਼ ਪੰਜਾਬੀ ਆਪਸ ਦੇ ਵਿੱਚ ਬੋਲਦੇ ਹਨ ਉਸ ਦੇ ਵਿੱਚ ਹੀ ਪੰਜਾਬੀ ਭਾਸ਼ਾ ਇੰਨੀ ਸੁੰਦਰ ਹੈ ਕਿ ਉਹਦੇ ਵਿੱਚ ਇੰਨੀ ਮਿਠਾਸ ਹੈ ਉਹਦੇ ਵਿੱਚ ਉਹਨਾਂ ਦਾ ਭਾਈਚਾਰਾ ਨਜ਼ਰ ਆਉਂਦਾ ਕਿ ਉਹ ਆਪਸ ਦੇ ਵਿੱਚ ਭਰਾ ਭਰਾ ਹਨ ਦੇਖੋ ਸਾਰਿਆਂ ਦਾ ਖੂਨ ਦਾ ਰੰਗ ਤਾਂ ਲਾਲ ਹੀ ਹੈ ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਮੇਂ ਹੈ ਭਾਈ ਭਾਈ ਜਿਵੇਂ ਸਾਡੇ ਤਿਉਹਾਰ ਲੋਹੜੀ ਬਸੰਤ ਹੋਲੀ ਵਿਸਾਖੀ ਈਦ ਬਕਰੀਦ ਦੁਸ਼ਹਿਰਾ ਦੀਵਾਲੀ ਕ੍ਰਿਸਮਿਸ ਅਸੀਂ ਨਵਾਂ ਸਾਲ ਵੀ ਰਲ ਮਿਲ ਕੇ ਮਨਾਉਂਦੇ ਹਾਂ ਜਿਹੜਾ ਸਾਡਾ ਗੁਰਮੁਖੀ ਦੇ ਵਿੱਚ ਨਵਾਂ ਸਾਲ ਸਿੱਖ ਧਰਮ ਦੇ ਵਿੱਚ ਆਉਂਦਾ ਹੈ ਚੇਤ ਦੇ ਮਹੀਨੇ ਉਹ ਵੀ ਸਾਰੇ ਰਲ ਮਿਲ ਕੇ ਮਨਾਉਂਦੇ ਆ ਸਾਰੇ ਗੁਰਪੁਰਬ ਅਸੀਂ ਰਲ ਕੇ ਮਨਾਉਂਦੇ ਹਾਂ ਜਦੋਂ ਵੀ ਕਿਤੇ ਸੇਵਾ ਲੰਗਰ ਦੇ ਵਿੱਚ ਲੰਗਰ ਛਕਣਾ ਕਿਤੇ ਸਿਮਰਨ ਹੋ ਰਿਹਾ ਅਤੇ ਸਾ ਉੱਥੇ ਇਹ ਜਾਤ ਪਾਤ ਦਾ ਭੇਦਭਾਵ ਮਿਟਾ ਕੇ ਕੋਈ ਨਹੀਂ ਪੁੱਛਦਾ ਕਿ ਤੁਸੀਂ ਕਿਸ ਜਾਤ ਨਾਲ ਮਤ ਰੱਖ ਸੰਬੰਧ ਰੱਖਦੇ ਹੋ ਸਾਰੇ ਰਲ ਕੇ ਬਹਿੰਦੇ ਹਨ ਰਲ ਕੇ ਹੀ ਲੰਗਰ ਛਕਦੇ ਹਨ ਇਤਿਹਾਸਿਕ ਦਿਨ ਤਾਂ ਸਾਨੂੰ ਅਸੀਂ ਸਾਰੇ ਇਕੱਠੇ ਰਲ ਕੇ ਮਨਾਉਂਦੇ ਹਨ ਕਈ ਪਰਿਵਾਰਾਂ ਵਿੱਚ ਤਾਂ ਇੱਕ ਭਰਾ ਹਿੰਦੂ ਆ ਇੱਕ ਮੁਸਲਮਾਨ ਹੈ ਜਾਂ ਇੱਕ ਸਿੱਖ ਹੈ ਪਰ ਉਹ ਆਪਸ ਦੇ ਵਿੱਚ ਇਕੱਠੇ ਹੀ ਰਹਿੰਦੇ ਹਨ ਕਿਉਂ ਕਿਉਂਕਿ ਉਹਨਾਂ ਦੇ ਵਿੱਚ ਖੂਨ ਦਾ ਰੰਗ ਹੀ ਲਾਲ ਹੈ ਸਾਡੇ ਸੱਭਿਆਚਾਰ ਲੋਕ ਗੀਤ ਇਹ ਵੀ ਸਾਨੂੰ ਦਿਖਾ ਦਰਸਾਉਂਦੇ ਹਨ ਕਿ ਸਾਡੇ ਗਿੱਧੇ ਦੀਆਂ ਬੋਲੀਆਂ ਡਾਂਡੀਆ ਆਪਸ ਦੇ ਵਿੱਚ ਸਾਰੇ ਤਿਉਹਾਰ ਉਹ ਨਹੀਂ ਪਤਾ ਲੱਗਦਾ ਸਾਨੂੰ ਕਿ ਕੋਈ ਗੁਜਰਾਤੀ ਹੈ ਜਾਂ ਪੰਜਾਬੀ ਆ ਡਾਂਡੀਆ ਅਸੀਂ ਇਕੱਠੇ ਹੀ ਖੇਡਦੇ ਹਾਂ